ਓਏ ਪੰਜਾਬ ਤਾਂ ਛੱਡੋ ਪੂਰੇ ਭਾਰਤ ਵਿੱਚ ਵੀ ਯੂਨੀਵਰਸਿਟੀਆਂ ਦੀ ਭਰਮਾਰ ਹੋ ਗਈ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਕਿਸੇ ਨੂੰ ਕੋਈ ਦਾਖਲੇ ਦੀ ਜ਼ਰੂਰਤ ਨਹੀਂ ਪੈਸਾ ਹੋਣਾ ਚਾਹੀਦਾ ਜਿੱਥੇ ਮਰਜ਼ੀ ਐਡਮੀਸ਼ਨ ਲੈ ਲਉ ਈਵਨ ਮੈਡੀਕਲ ਦੇ ਵਿੱਚ ਪੇਡ ਸੀਟਾਂ ਹੈ ਐਮ ਬੀ ਬੀ ਐੱਸ ਡਾਕਟਰ ਬਣ ਜਾਉ ਚਾਹੇ ਤੁਸੀਂ ਉਸ ਦੇ ਕਾਬਿਲ ਹੋਏ ਜਾਂ ਨਹੀਂ